ਟੈਕਨੋਲੋਜੀ ਦੇ ਬਹੁਤ ਸਾਰੇ ਬੁਨਿਆਦੀ ਰੂਪ ਹਨ ਜਿਹੜੇ ਕਿ ਮੈਂ ਆਪਣੇ ਆਲੇ ਦੁਆਲੇ ਦੇਖਦੀ ਹਾਂ ਅਤੇ ਇਸਨੇ ਸਾਡੇ ਜੀਵਨ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ ਹੈ ਜਿਸ ਵਿੱਚੋਂ ਪਹਿਲਾ ਮੋਬਾਇਲ ਫੋਨ ਹੈ ਜਿਹੜਾ ਕਿ ਲਗਭਗ ਹਰ ਇਨਸਾਨ ਕੋਲ ਹੈ ਇਸ ਨਾਲ ਲਗਭਗ ਸਾਰੇ ਹੀ ਕੰਮ ਹੋ ਜਾਂਦੇ ਹਨ ਜਿਵੇਂ ਕਿ ਆਪਾਂ ਕਿਸੇ ਦੀ ਵੀ ਹੈਲਪ ਕਰ ਸਕਦੇ ਹਾਂ ਜਿਵੇਂ ਕਿ ਕਿਸੇ ਨੂੰ ਪੈਸੇ ਸੈਂਡ ਕਰਨੇ ਜਾਂ ਫਿਰ ਮੰਗਵਾਉਣੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕੰਮ ਹਨ ਜਿਹੜੇ ਕਿ ਆਪਾਂ ਮੋਬਾਈਲ ਫੋਨ ਦੁਆਰਾ ਕਰ ਸਕਦੇ ਹਾਂ ਇਸ ਤੋਂ ਇਲਾਵਾ ਵਾਸ਼ਿੰਗ ਮਸ਼ੀਨਸ ਜਿਵੇਂ ਕਿ ਪਹਿਲੇ ਜ਼ਮਾਨੇ ਵਿੱਚ ਔਰਤਾਂ ਹੱਥਾਂ ਨਾਲ ਕੱਪੜੇ ਧੋਂਦੀਆਂ ਸਨ ਇਸ ਟੈਕਨੋਲਜੀ ਦੇ ਆਉਣ ਨਾਲ ਹੁਣ ਇਹ ਕੰਮ ਵਾਸ਼ਿੰਗ ਮਸ਼ੀਨ ਦੁਆਰਾ ਕਰਨਾ ਆਸਾਨ ਹੋ ਗਿਆ ਹੈ ਇਸ ਤੋਂ ਇਲਾਵਾ ਟਰਾਂਸਪੋਰਟ ਜਿਵੇਂ ਕਿ ਲੋਕ ਪਹਿਲੇ ਸਮੇਂ ਵਿੱਚ ਪੈਦਲ ਤੁਰਦੇ ਸਨ ਟੈਕਨੋਲਜੀ ਦੇ ਆਉਣ ਨਾਲ ਹੁਣ ਸਫਰ ਕਰਨਾ ਸੌਖਾ ਹੋ ਗਿਆ ਹੈ ਧੰਨਵਾਦ